ਸਤਿ ਸ਼੍ਰੀ ਅਕਾਲ ਮੈਨੂੰ ਮੈਨੂੰ ਤਾਂ ਡਾਂਸ ਦੀਆਂ ਤਿੰਨ ਹੀ ਸ਼ੈਲੀਆਂ ਪਸੰਦ ਆ ਫੋਮ ਜਿਹਨਾਂ ਨੂੰ ਕਹਿੰਦੇ ਹਾਂ ਇੱਕ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆ ਭੰਗੜਾ ਦੂਜਾ ਮੈਨੂੰ ਗਿੱਧਾ ਬਹੁਤ ਪਸੰਦ ਆ ਅਤੇ ਤੀਸਰਾ ਮੇਰਾ ਜਿਹੜਾ ਪਸੰਦੀਦਾ ਆ ਉਹ ਬੋਲੀਵੁੱਡ ਆ ਕਿਉਂਕਿ ਬੋਲੀਵੁੱਡ ਜਿਹੜਾ ਆ ਉਹ ਜਿਹੜਾ ਆ ਹਮੇਸ਼ਾ ਕਹਿੰਦੇ ਆ ਨਾ ਔਲਡ ਇਜ ਗੋਲਡ ਉਹੀ ਰਹਿੰਦਾ ਆ ਅਤੇ ਬੋਲੀਵੁੱਡ 'ਚ ਜੇ ਤੁਸੀਂ ਕਿਸੇ ਵੀ ਫਰੀ ਸਟਾਈਲ ਤਰੀਕੇ ਨਾਲ ਤੁਸੀਂ ਡਾਂਸ ਕਰ ਸਕਦੇ ਹੋ ਇਸ ਕਰਕੇ ਬਹੁਤ ਵਧੀਆ ਲੱਗਦਾ ਅਤੇ ਜਿੱਦਾਂ ਕਿ ਅਸੀਂ ਪੰਜਾਬੀ ਹਾਂ ਅਤੇ ਭੰਗੜਾ ਤਾਂ ਸਾਡਾ ਫੇਵਰੇਟ ਹੀ ਆ ਹੈ ਨਾ ਬੁ ਸਭ ਤੋਂ ਜ਼ਿਆਦਾ ਪਸੰਦੀਦਾ ਤਾਂ ਸਾਨੂੰ ਭੰਗੜਾ ਹੀ ਆਉਂਦਾ ਅਤੇ ਭੰਗੜਾ ਤਾਂ ਬਹੁਤ ਪਸੰਦ ਆ ਭੰਗੜਾ ਭੰਗੜਾ ਇੱਕ ਤਰੀਕੇ ਦੀ ਫੀਲ ਆ ਜਦੋਂ ਅਸੀਂ ਭੰਗੜਾ ਕਰਦੇ ਹਾਂ ਤਾਂ ਸਾਨੂੰ ਆਪਣਾ ਜਿਹਾ ਫੀਲ ਹੁੰਦਾ ਆਪਣਾਪਨ ਫੀਲ ਹੁੰਦਾ ਅਤੇ ਜਿੱਦਾਂ ਕੋਈ ਵੀ ਸਾਡੇ ਫੰਕਸ਼ਨ ਹੋਏਗਾ ਕੋਈ ਵੀ ਮੈਰਿਜ ਹੋਏਗੀ ਕੋਈ ਵੀ ਵਿਆਹ ਸ਼ਾਦੀ ਹੋਏਗੀ ਤਾਂ ਸਾਨੂੰ ਕੁਝ ਨਹੀਂ ਦਿਖਦਾ ਅਸੀਂ ਭੰਗੜਾ ਹੀ ਪਾਉਂਦੇ ਹਾਂ ਅਤੇ ਤੀਜਾ ਜਿਹੜਾ ਗਿੱਧਾ ਉਹ ਤਾਂ ਸਾਡਾ ਟਰਡੀਸ਼ਨਲ ਡਾਂਸ ਆ ਕਿਸੇ ਵੀ ਡਾਂਸ ਕੋਂਪੀਟੀਸ਼ਨ ਹੋ ਜਾਵੇ ਕੋਈ ਵੀ ਸਕੂਲ ਦਾ ਫੰਕਸ਼ਨ ਹੋ ਜਾਵੇ ਕੋਈ ਵੀ ਐਨੂਅਲ ਡੇਅ ਫੰਕਸ਼ਨ ਕੋਈ ਕੋਲਜ ਦਾ ਅਤੇ ਕੁੜੀਆਂ ਦਾ ਗਿੱਧਾ ਤਾਂ ਬਹੁਤ ਜ਼ਰੂਰੀ ਹੁੰਦਾ ਕਰਨਾ ਅਤੇ ਇਸ ਕਰਕੇ ਹਮੇਸ਼ਾ ਤੋਂ ਕਰਦੇ ਆਏ ਆ ਇਸ ਕਰਕੇ ਗਿੱਧਾ ਤਾਂ ਬਹੁਤ ਜ਼ਿਆਦਾ ਪਸੰਦ ਹੈ ਅਤੇ ਇਹੀ ਤਿੰਨੋ ਡਾਂਸ ਫੋਰਮਸ ਜਿਹੜੇ ਆ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆ ਅਤੇ ਸਭ ਤੋਂ ਜ਼ਿਆਦਾ ਮੇਰਾ ਫੇਵਰੇਟ ਜਿਹੜਾ ਆ ਉਹ ਮੈਨੂੰ ਭੰਗੜਾ ਲੱਗਦਾ ਮੈਨੂੰ ਭੰਗੜਾ ਬਹੁਤ ਪਸੰਦ ਆ